ਭਾਰਤੀ ਸਿਹਤ ਸੰਭਾਲ ਦੀ ਤਾਂ ਠੀਕ ਏ ਜਿੱਦਾਂ ਆਪਾਂ ਭਾਰਤ ਦੀ ਗੱਲ ਕਰਦੇ ਸਰਕਾਰੀ ਹੋਸਪੀਟਲ ਦੀ ਗੱਲ ਕਰਦੇ ਹਾਂ ਇਸ ਚੀਜ਼ ਵਿੱਚ ਸਰਕਾਰੀ ਹੋਸਪੀਟਲ ਵਿੱਚ ਬਹੁਤ ਜੀ ਕਮੀ ਹੈ ਪਹਿਲੀ ਗੱਲ ਤਾਂ ਜੀ ਸਫਾਈ ਦੀ ਪੂਰੀ ਸਫਾਈ ਨਹੀਂ ਹੁੰਦਾ ਦੂਸਰੀ ਕੀ ਜੀ ਕੋਈ ਟੈਸਟ ਕਰਾਣਾ ਹੋਵੇ ਤਾਂ ਕੋਈ ਕਦੇ ਸਟਾਫ ਨਹੀਂ ਪੂਰਾ ਹੁੰਦਾ ਸਟਾਫ ਪੂਰਾ ਹੋਏ ਅਤੇ ਕੋਈ ਲੈਬ ਨਹੀਂ ਲੈਬ 'ਚ ਸਮਾਨ ਨਹੀਂ ਹੁੰਦਾ ਇਹ ਸਾਨੂੰ ਬਾਹਰ ਜਾ ਕਰਾਣਾ ਪੈਂਦਾ ਟੈਸਟ ਟੁਸਟ ਹਰੇਕ ਬੰਦਾ ਅਫੋਰਡ ਨਹੀਂ ਕਰ ਸਕਦਾ ਟੈਸਟ ਟੈਸਟ ਮਹਿੰਗੇ ਹੁੰਦੇ ਨੇ ਸਰਕਾਰੀ ਹੋਸ ਸਰਕਾਰੀ ਹੋਸਪੀਟਲ ਦਾ ਇਹੀ ਫਾਇਦਾ ਏ ਕਿ ਬੰਦੇ ਦਾ ਆਪਾਂ ਗਰੀਬ ਬੰਦਾ ਕਰਾ ਸਕਦਾ ਏ ਪਰ ਇਹ ਸਰਕਾਰੀ ਹੋਸਪੀਟਲ 'ਚ ਇਹ ਨਾ ਹੋਣ ਕਰਕੇ ਗਰੀਬ ਬੰਦਾ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਬਾਹਰ ਜਾਣਾ ਪੈਂਦਾ ਹੈ ਪ੍ਰਾਈਵੇਟ ਹੋਸਪੀਟਲਾਂ 'ਚੋਂ ਪ੍ਰਾਈਵੇਟ ਕ ਕਿਤੇ ਥਾਂ ਜਿੱਥੇ ਕੋਈ ਕਰਦੇ ਐਂ ਇਹ ਆਪਾ ਆਪਾਂ ਅਫੋਰਡ ਨਹੀਂ ਕਰ ਸਕਦੇ ਹਾਂ ਇਹਨਾਂ 'ਚੋਂ ਸਰਕਾਰੀ ਹੋਸਪਿਟਲਾਂ 'ਚ ਬਹੁਤ ਜੀ ਕਮੀ ਐਂ ਕਮੀਆਂ ਇਹ ਕਮੀਆਂ ਸਾਨੂੰ ਦੂਰ ਕਰਨੀਆਂ ਪੈਣੀਆਂ ਨਹੀਂ ਤਾਂ ਇਹ ਗਰੀਬ ਬੰਦਾ ਇਹਦੇ ਥੱਲੇ ਦੱਬੀ ਜਾਂਦਾ ਏ ਦੱਬੀ ਜਾ ਰਿਹਾ ਏ